ਪੰਜਾਬ ਦਾ ਸੱਭਿਆਚਾਰ ਬਹੁਤ ਹੀ ਮਹਾਨ ਹੈ ਇਸ ਵਿੱਚ ਬਹੁਤ ਸਾਰੇ ਕਿੱਤੇ ਹਨ ਜਿਵੇਂ ਕਿ ਪਸ਼ੂ ਪਾਲਣ ਪਸ਼ੂ ਪਾਲਣ ਖੇਤੀਬਾੜੀ ਇਹਦਾ ਮੁੱਖ ਕਿੱਤਾ ਹੈ ਇਸ ਤਰ੍ਹਾਂ ਹੀ ਜੇ ਔਰਤਾਂ ਦੇ ਕਿੱਤਿਆਂ ਦੀ ਗੱਲ ਕੀਤੀ ਜਾਵੇ ਤਾਂ ਔਰਤਾਂ ਦਾ ਚਰਖਾ ਕੱਤਣਾ ਦੁੱਧ ਰਿੜਕਣਾ ਮੰਜੇ ਬੁਣਨਾ ਆਦਿ ਬਹੁਤ ਸਾਰੇ ਕਿੱਤੇ ਹਨ ਪਰ ਸਮੇਂ ਦੇ ਨਾਲ ਨਾਲ ਇਹ ਸਾਰੇ ਕਿੱਤੇ ਬਦਲ ਰਹੇ ਨੇ ਅੱਜ ਕੱਲ ਖੇਤੀਬਾੜੀ ਦਾ ਜਿਹੜਾ ਖੇਤੀਬਾੜੀ ਦਾ ਦੌਰ ਆ ਉਹ ਦਿਨੋਂ ਦਿਨ ਘੱਟ ਰਿਹਾ ਇਸ ਤਰ੍ਹਾਂ ਹੀ ਜੇ ਆਪਾਂ ਘਰ ਦੀ ਗੱਲ ਕਰੀਏ ਤਾਂ ਜਿਹੜਾ ਪਸ਼ੂ ਪਾਲਣ ਆ ਉਹ ਵੀ ਬਹੁਤ ਜ਼ਿਆਦਾ ਘੱਟ ਰਿਹਾ ਹੈ ਅੱਜ ਕੱਲ ਘਰ ਦੇ ਕੰਮਾਂ ਦੀ ਥਾਂ ਤਾਂ ਮੋਬਾਇਲ ਫੋਨ ਨੇ ਲੈ ਲਈ ਹੈ ਅੱਜ ਕੱਲ ਘਰ ਦੀਆਂ ਘਰ ਪਰਿਵਾਰ ਪੰਜਾਬ ਦੇ ਜਿਹੜੇ ਨਵੀਂ ਨਵੀਂ ਜਨਰੇਸ਼ਨ ਆ ਉਹ ਅੱਜ ਕੱਲ ਅ ਪੁਰਾਣੇ ਕਿੱਤਿਆਂ ਨੂੰ ਛੱਡ ਕੇ ਨਵੇਂ ਕਿੱਤੇ ਅਪਣਾ ਰਹੀ ਹੈ ਅੱਜ ਕੱਲ ਅੱਜ ਕੱਲ ਦੇ ਜਿਹੜੇ ਪੀੜੀ ਆ ਉਹ ਜ਼ਿਆਦਾਤਰ ਫੋਨਾਂ 'ਤੇ ਡਿਪੈਂਡ ਹੋ ਗਈ ਆ ਅਤੇ ਪੁਰਾਣੇ ਜਿਹੜੇ ਕਿੱਤੇ ਆ ਉਹ ਦਿਨੋਂ ਦਿਨ ਘੱਟ ਰਹੇ ਹਨ ਜਿਵੇਂ ਕਿ ਖੇਤੀਬਾੜੀ ਪਸ਼ੂ ਪਾਲਣ ਬਹੁਤ ਜ਼ਿਆਦਾ ਘੱਟ ਰਿਹਾ ਅੱਜ ਕੱਲ ਦੇ ਜਿਹੜੇ ਨੌਜਵਾਨ ਪੀੜੀ ਆ ਉਹ ਖੇਤੀਬਾੜੀ ਛੱਡ ਕੇ ਬਾਹਰ ਜਾਣਾ ਜ਼ਿਆਦਾ ਪਸੰਦ ਕਰਦੀ ਹੈ ਇਸ ਤਰ੍ਹਾਂ ਸਾਨੂੰ ਇਸ ਤਰ੍ਹਾਂ ਸਾਡੇ ਜਿਹੜੇ ਕਿੱਤੇ ਆ ਉਹ ਪੀੜੀ ਦਰ ਪੀੜੀ ਨਹੀਂ ਰਹੇ ਇਹ ਸਗੋਂ ਕਿਤੇ ਬਾਹਰ ਚਲੇ ਗਏ ਹਨ ਇਸ ਲਈ ਸਾਨੂੰ ਇਸ ਨੂੰ ਇਸ ਲਈ ਸਾਨੂੰ ਆਪਣੇ ਪੰਜਾਬ ਦੇ ਕਿੱਤੇ ਨੂੰ ਵਾਪਸ ਲੈ ਕੇ ਆਉਣਾ ਚਾਹੀਦਾ ਹੈ